ਭਾਰਤੀ ਮੀਡੀਆ ਜੋ ਹੈ ਜੋ ਸਰਕਾਰੀ ਮੀਡੀਆ ਹੈ ਉਹ ਪੂਰੀ ਤਰ੍ਹਾਂ ਸਰਕਾਰ ਕੋਲ ਵਿਕਾਊ ਲਗਦਾ ਹੈ ਜੋ ਅਸਲੀ ਤੱਥ ਹਨ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ ਕੇਵਲ ਜੋ ਸਰਕਾਰ ਚਾਹੁੰਦੀ ਹੈ ਲੋਕਾਂ ਨੂੰ ਦੱਸਣਾ ਉਹੀ ਚੀਜ਼ਾਂ ਅੱਗੇ ਆ ਰਹੀਆਂ ਹਨ ਕੇਵਲ ਡੇਟੇ ਜੋ ਹੈ ਡੇਟਾ ਵੇਸ਼ਡ ਚੀਜ਼ਾਂ ਉਹ ਗਲਤ ਦਿਖਾਈਆਂ ਜਾ ਰਹੀਆਂ ਜਿਹੜੀਆਂ ਕਿ ਵਾਸਤਵਿਕ ਰੂਪ ਵਿੱਚ ਹੋਰ ਹੁੰਦੀਆਂ ਹਨ ਅਤੇ ਜਿਹੜੀਆਂ ਖ਼ਬਰਾਂ ਹੈ ਉਹ ਵੀ ਢੁਕਵੀਆਂ ਨਹੀਂ ਦਈਆਂ ਜਾ ਰਹੀਆਂ ਉਹਨਾਂ ਨੂੰ ਵੀ ਤੋੜ ਮਰੋੜ ਕੇ ਉਹਨਾਂ ਦਾ ਰੂਪ ਬਦਲ ਕੇ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਔਰ ਲਗਦਾ ਹੈ ਕਿ ਅੱਜ ਕੱਲ੍ਹ ਸਾਡਾ ਅਖ਼ਬਾਰ ਔਰ ਸਾਡਾ ਮੀਡੀਆ ਇਹ ਸਰਕਾਰ ਦੇ ਹੱਥਾਂ ਦੇ ਕਠਪੁਤਲੀ ਬਣ ਚੁੱਕਾ ਹੈ ਅਤੇ ਜਿਹੜੇ ਮਜ਼ ਮਸ਼ਹੂਰ ਅਖ਼ਬਾਰ ਹਨ ਇੱਕ ਪੰਜਾਬੀ ਵਿੱਚ ਅਜੀਤ ਹੈ ਜਗ ਬਾਣੀ ਹੈ ਹਿੰਦੀ ਦੇ ਵਿੱਚ ਦੈਨਿਕ ਜਾਗਰਣ ਹੈ ਪੰਜਾਬ ਕੇਸਰੀ ਹੈ ਜਨ ਸੱਤਾ ਹੈ ਇਹ ਅਖ਼ਬਾਰ ਮੁੱਖ ਹਨ